ਮੈਂ ਸਕੂਲ ਦੇ ਫੰਕਸ਼ਨ ਵਿੱਚ ਹਿੱਸਾ ਲਿਆ ਹੈ ਅਤੇ ਮੇਰਾ ਤਜ਼ਰਬਾ ਬਹੁਤ ਵਧੀਆ ਰਿਹਾ ਹੈ ਜਿਵੇਂ ਮੈਂ ਆਖਰੀ ਵਾਰ ਆਪਣੇ ਸਕੂਲ ਵਿੱਚ ਗਿੱਧੇ ਦੇ ਵਿੱਚ ਹਿੱਸਾ ਲਿਆ ਸੀ ਗਿੱਧੇ ਨੂੰ ਪਾ ਕੇ ਮਨ ਬਿਲਕੁਲ ਹੀ ਖੁਸ਼ ਹੋ ਜਾਂਦਾ ਹੈ ਅਤੇ ਉੱਥੇ ਆਏ ਲੋਕ ਗਿੱਧੇ ਨੂੰ ਵੇਖ ਬਹੁਤ ਖੁਸ਼ ਹੋ ਜਾਂਦੇ ਹੈ ਗਿੱਧੇ ਨੂੰ ਦੁਬਾਰਾ ਪਵਾਉਣ ਦੀ ਵੀ ਮੰਗ ਕਰਦੇ ਹਨ